ਇਕੱਤੀ ਮਈ ਉੱਨੀ ਸੌ ਬਹੱਤਰ ਉੱਨੀ ਅਕਤੂਬਰ ਦੋ ਹਜ਼ਾਰ ਦੋ ਵੀਹ ਨਵੰਬਰ ਦੋ ਹਜ਼ਾਰ ਸੱਤ ਚੌਦ੍ਹਾਂ ਜਨਵਰੀ ਵੀਹ ਸੌ ਦਸ ਤੇਈ ਨਵੰਬਰ ਵੀਹ ਸੌ ਤੇਈ